ਹਸਪਤਾਲਾਂ ਦੇ ਵਿੱਚ ਇਲਾਜ ਲਈ ਜਾਣ ਲਈ ਅੱਜ ਕੱਲ੍ਹ ਲੋਕਾਂ ਨੂੰ ਬਹੁਤ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਪਹਿਲਾਂ ਤਾਂ ਹਸਪਤਾਲਾਂ ਵਿੱਚ ਇਲਾਜ ਕਰਵਾਉਣ ਦੀ ਰਸੀਦ ਬਣਵਾਉਣ ਲਈ ਲੰਬੀਆਂ ਲਾਈਨਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਸਵੇਰ ਤੋਂ ਹੀ ਖੱਜਲ ਹੋਣਾ ਪੈਂਦਾ ਹੈ ਮਰੀਜ਼ ਪਹਿਲਾਂ ਤੋਂ ਹੀ ਬਿਮਾਰੀ ਨੂੰ ਲੈ ਕੇ ਤੰਗ ਹੁੰਦਾ ਹੈ ਉੱਤੋਂ ਇਹ ਸਭ ਮੁਸੀਬਤਾਂ ਕਰਕੇ ਹੋਰ ਤੰਗ ਹੋ ਜਾਂਦਾ ਹੈ ਫਿਰ ਡਾਕਟਰ ਨੂੰ ਮਿਲਣ ਲਈ ਵੀ ਲੰਬੀ ਕਤਾਰਾਂ ਵਿੱਚ ਲੱਗਣਾ ਪੈਂਦਾ ਹੈ ਨਾ ਕੁਝ ਬੈਠਣ ਦਾ ਪ੍ਰਬੰਧ ਹੁੰਦਾ ਹੈ ਫਿਰ ਜੇ ਡਾਕਟਰ ਕੋਈ ਟੈਸਟ ਲਿਖ ਦੇਵੇ ਤਾਂ ਮਰੀਜ਼ ਨੂੰ ਉਹ ਦੂਜੀ ਇਮਾਰਤ ਵਿੱਚ ਜਾਂ ਦੱਸੀ ਗਈ ਜਗ੍ਹਾ 'ਤੇ ਹੀ ਟੈਸਟ ਕਰਵਾਉਣ ਲਈ ਜਾਣਾ ਪੈਂਦਾ ਹੈ ਫਿਰ ਉੱਥੇ ਵੀ ਲੰਬੀ ਲਾਈਨਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਫਿਰ ਜਦੋਂ ਡਾਕਟਰ ਦਵਾਈ ਲਿਖ ਦੇਵੇ ਤਾਂ ਮਰੀਜ਼ ਨੂੰ ਉਹ ਵੀ ਬਾਹਰੋਂ ਲੈਣ ਜਾਣਾ ਪੈਂਦਾ ਹੈ ਜਦਕਿ ਹੋਣਾ ਇਹ ਚਾਹੀਦਾ ਹੈ ਕਿ ਇਹ ਸਭ ਚੀਜ਼ ਦਾ ਹੱਲ ਹਸਪਤਾਲ ਆਪ ਕਰੇ ਤਾਂ ਕਿ ਮਰੀਜ਼ ਨੂੰ ਖੱਜਲ ਨਾ ਹੋਣਾ ਪਵੇ ਹਸਪਤਾਲਾਂ ਵਾਲੇ ਇੰਨਾ ਪੈਸਾ ਵੀ ਲੈਂਦੇ ਨੇ ਫਿਰ ਵੀ ਮਰੀਜ਼ ਨੂੰ ਹੀ ਤੰਗ ਹੋਣਾ ਪੈਂਦਾ ਹੈ ਅਤੇ ਨਰਸਾਂ ਦਾ ਵਿਹਾਰ ਵੀ ਕੁਝ ਸਹੀ ਨਹੀਂ ਹੁੰਦਾ ਕੁਝ ਨਰਸਾਂ ਤਾਂ ਚੰਗੀਆਂ ਹੁੰਦੀਆਂ ਨੇ ਮਰੀਜ਼ ਦਾ ਦੁੱਖ ਸੁੱਖ ਸਮਝਣ ਵਾਲੀਆਂ ਹੁੰਦੀਆਂ ਨੇ ਅਤੇ ਉਹਨਾਂ ਦਾ ਸੁਭਾਅ ਚੰਗਾ ਹੁੰਦਾ ਹੈ ਅਤੇ ਕੁਝ ਨਰਸਾਂ ਇਹੋ ਜਿਹੀਆਂ ਹੁੰਦੀਆਂ ਨੇ ਕਿ ਸਿਰਫ ਉਹ ਆਪਣੀ ਡਿਊਟੀ ਪੂਰੀ ਕਰਦੀਆਂ ਨੇ ਇਹਨਾਂ ਸਭ ਔਕੜਾਂ ਅਤੇ ਪਰੇਸ਼ਾਨੀਆਂ ਕਾਰਨ ਮਰੀਜ਼ ਨੂੰ ਬਹੁਤ ਦਿੱਕਤ ਆਉਂਦੀ ਹੈ